ਸਾਡੇ ਖੇਤਰ ਦੇ ਹਸਪਤਾਲਾਂ ਵਿੱਚ ਜ਼ਿਆਦਾ ਭੀੜ ਅਤੇ ਲੰਬੇ ਇੰਤਜ਼ਾਰ ਦਾ ਕੁਛ ਵੀ ਦੇਖਣ ਨੂੰ ਨਹੀਂ ਮਿਲਦਾ ਕਿਉਂਕਿ ਅੱਜ ਕੱਲ੍ਹ ਸਭ ਕੁਝ ਕੰਪਿਊਟਰਾਈਜ਼ਡ ਹੋ ਗਿਆ ਹੈ ਜਿਸ ਨਾਲ਼ ਲੋਕ ਪਹਿਲਾਂ ਤੋਂ ਹੀ ਆਪਣੀ ਔਨਲਾਈਨ ਬੁਕਿੰਗ ਕਰਵਾ ਲੈਂਦੇ ਹਨ ਇਸ ਨਾਲ਼ ਉਹਨਾਂ ਦਾ ਸਮਾਂ ਵਧੇਰੇ ਬਚ ਜਾਂਦਾ ਹੈ ਅਤੇ ਉਹਨਾਂ ਨੂੰ ਜ਼ਿਆਦਾਤਰ ਲੰਬੇ ਸਮੇਂ ਭੀੜ ਵਿੱਚ ਵੀ ਨਹੀਂ ਖੜ੍ਹਨਾ ਪੈਂਦਾ